ਮੈਂ ਅਤੇ ਮੇਰਾ ਦੋਸਤ ਇੱਕ ਹੋਸਟਲ ਵਿੱਚ ਰਹਿੰਦੇ ਸਨ ਅਸੀਂ ਉਸਨੇ ਜਦੋਂ ਪਾਣੀ ਦਾ ਬਿੱਲ ਆਇਆ ਅਤੇ ਉਸਨੇ ਮੈਨੂੰ ਬਿੱਲ ਚੈੱਕ ਕਰਵਾਇਆ ਅਤੇ ਕਿਹਾ ਕਿ ਇਸ ਵਾਰ ਪਾਣੀ ਦਾ ਬਿੱਲ ਬਹੁਤ ਜ਼ਿਆਦਾ ਆਇਆ ਹੈ ਅਤੇ ਮੈਂ ਚੈੱਕ ਕੀਤਾ ਅਤੇ ਪੁਰਾਣੇ ਬਿੱਲ ਕੱਢੇ ਅਤੇ ਦੇਖਿਆ ਉਹਦੇ ਵਿੱਚ ਬਿੱਲ ਘੱਟ ਸੀ ਅਤੇ ਇਸ ਵਾਰ ਬਿੱਲ ਜ਼ਿਆਦਾ ਲੱਗ ਕੇ ਆਇਆ ਸੀ ਅਤੇ ਮੈਂ ਆਪਣੇ ਦੋਸਤਾਂ ਦੀ ਸਲਾਹ ਲਈ ਕਿ ਇਸਦੀ ਸ਼ਿਕਾਇਤ ਕਿੱਥੇ ਕੀਤੀ ਜਾਵੇ ਅਤੇ ਬਿੱਲ ਕਿਉਂ ਜ਼ਿਆਦਾ ਆਇਆ ਹੈ ਅਤੇ ਫਿਰ ਮੈਂ ਅਸੀਂ ਇੰਨਾਂ ਪਾਣੀ ਯੂਜ ਨਹੀਂ ਕੀਤਾ ਜਦ ਕਿ ਫਿਰ ਵੀ ਉਹਨਾਂ ਨੇ ਉਹਨਾਂ ਵੀ ਬਿੱਲ ਜ਼ਿਆਦਾ ਭੇਜਿਆ ਜਦ ਕੇ ਅਸੀਂ ਸਵੇਰ ਤੋਂ ਸ਼ਾਮ ਹੋਸਟਲ ਤੋਂ ਬਾਹਰ ਜ਼ਿਆਦਾ ਰਹਿੰਦੇ ਹਾਂ ਹੋਸਟਲ ਵਿੱਚ ਘੱਟ ਰਹਿੰਦੇ ਹਾਂ ਕਲਾਸਾਂ ਦੇ ਵਿੱਚ ਕਾਲਜ ਦੇ ਵਿੱਚ ਜ਼ਿਆਦਾ ਦੇਰ ਰਹਿੰਦੇ ਹਾਂ ਸਾਡੀ ਇੰਨੀ ਕੋਈ ਆਮਦਨ ਨਹੀਂ ਹੈ ਜਿਸ ਕਰਕੇ ਅਸੀਂ ਬਿੱਲ ਭਰਾ ਸਕੀਏ ਨਾ ਨਾ ਅਸੀਂ ਸਾਡੀ ਪਾਣੀ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਫਿਰ ਵੀ ਇਹਨਾਂ ਬਿੱਲ ਭੇਜ ਦਿੱਤਾ ਹੈ ਇਹਨਾਂ ਨੇ ਤਾਂ ਹੀ ਜਦੋਂ ਮੈਂ ਦੇਖਿਆ ਬਿੱਲ ਜ਼ਿਆਦਾ ਹੈ ਅਤੇ ਮੈਂ ਬਿੱਲ ਚੈਕ ਕਰਾਉਣ ਬਾਰੇ ਸੋਚਿਆ